ਪੰਜਾਬ ਵਿੱਚ ਖੇਡ ਖੇਤਰ ਵਿੱਚ ਕਾਰਗੁਜ਼ਾਰੀ ਨੂੰ ਰੋਕਣ ਲਈ ਸਰਕਾਰ ਨੇ ਕਈ ਕੁਝ ਮਾਨਕ ਅਤੇ ਨਿਯਮ ਲਾਏ ਹਨ ਅਤੇ ਨਿਰੀਖਣ ਤਥਾ ਕਾਰਵਾਈ ਦੀ ਵਧੇਰੀ ਕੀਤੀ ਹੈ ਇਸ ਨੂੰ ਸੰਭਾਲਣ ਲਈ ਵਿਭਾਗਾਂ ਦੇ ਤਾਲੀਮ ਅਤੇ ਜਗ ਜਾਗਰੁਕਤਾ ਕਾਰ ਕਾਰਗੁਜ਼ਾਰੀ ਦੀ ਚੰਗੀ ਪਰਵਾਹ ਲਈ ਲਈ ਗਈ ਅ ਅਦਾਰੇ ਅਤੇ ਪ੍ਰੋਗਰਾਮ ਚਲਾਏ ਹਨ ਇਸ ਤੋਂ ਇਲਾਵਾ ਸ਼ੈਲੀ ਮਾਰ ਬਾਗ ਵਿੱਚ ਖੇਡ ਪ੍ਰੀਕਸ਼ਣ ਕੇਂਦਰ ਵੀ ਸਰਾ ਸਥਾਪਿਤ ਕੀਤਾ ਗਿਆ ਹੈ ਜਿੱਥੇ ਖਿਡਾਰੀਆਂ ਨੂੰ ਡੋਪਿੰਗ ਅਤੇ ਕਾਰਗੁਜ਼ਾਰੀ ਬਾਰੇ ਸਾਬਕਾ ਸਿਖਲਾਈ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਨਿਰੀਖਣ ਅਤੇ ਸਜ਼ਾ ਦੇ ਲਈ ਕਾਨੂੰਨੀ ਕਾਰਵਾਈ ਵਧਾਈ ਗਈ ਹੈ ਇਸ ਤਰ੍ਹਾਂ ਇਹ ਸਭ ਕੁਝ ਨਾਸਤਰੀ ਤੌਰ 'ਤੇ ਸਮਰਥਨ ਅਤੇ ਪ੍ਰੇਰਨਾ ਮੁਹੱਈਆ ਕਰਦਾ ਹੈ ਤਾਂ ਕਿ ਡੋਪਿੰਗ ਅਤੇ ਕਾਰਗੁਜ਼ਾਰੀ ਨੂੰ ਰੋਕਿਆ ਜਾ ਸਕੇ